ਮੈਂ ਚਾਹੁੰਦੀ ਹਾਂ ਕਿ ਬੈਂਕ ਆਪਣੇ ਗਾਹਕਾਂ ਨੂੰ ਹੋਮ ਲੋਨ ਵਾਸਤੇ ਘੱਟ ਤੋਂ ਘੱਟ ਪ੍ਰਸੈਟੇਜ਼ ਲਾਵੇ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਆਪਣੇ ਘਰ ਦਾ ਅਤੇ ਸਾਨੂੰ ਜੇ ਉਹ ਸੇਵਾ ਬੈਂਕ ਵਾਲੇ ਵਧੀਆ ਦੇਣ ਅਤੇ ਮੈਂ ਵੀ ਚਾਹੁੰਦੀ ਹਾਂ ਮੇਰਾ ਘਰ ਹੋਵੇ ਅਤੇ ਨਹੀਂ ਘਰ ਹੈਗਾ ਬੈਂਕ ਵਾਲੇ ਕੁਛ ਲੋਨ ਸਹੂਲਤਾਂ ਦੇਣ ਅਤੇ ਉਹਨਾਂ ਖੇਤਰਾਂ ਵਿੱਚ ਮਤਲਬ ਕੀਤਾ ਜਾਵੇ ਹੈ ਨਾ ਅਤੇ ਬੈਂਕ ਵਾਲਿਆਂ ਨੂੰ ਚਾਹੀਦਾ ਵਾ ਹਰ ਇੱਕ ਚੀਜ਼ ਦੀ ਵਧੀਆ ਤਰੀਕੇ ਨਾਲ ਸਾਨੂੰ ਜੋ ਵੀ ਆ ਉੱਥੇ ਵਧੀਆ ਤਰੀਕੇ ਨਾਲ ਸਾਨੂੰ ਪੇਸ਼ ਆਉਣ ਸਾਡੇ ਅੱਗੇ ਅਤੇ ਅਸੀਂ ਬੈਂਕ ਵਾਲਿਆਂ ਨੂੰ ਚਾਹੁੰਦੇ ਹਾਂ ਕਿ ਸਾਨੂੰ ਚੰਗੀ ਤਰ੍ਹਾਂ ਉੱਥੇ ਪੇਸ਼ ਆਉਣ ਸਾਨੂੰ ਕਿੰਨੇ ਕਿੰਨੇ ਘੰਟੇ ਇੰਤਜ਼ਾਰ ਕਰਾਉਂਦੇ ਆ ਅਤੇ ਆਪਣੇ ਹੋਨ ਲੋਨ 'ਤੇ ਖ਼ਾਸ ਕਰਕੇ ਦਰਾਂ ਘੱਟ ਕੀਤੀਆਂ ਜਾਣ ਕਿ ਸਾਡਾ ਵੀ ਮੇਰਾ ਵੀ ਸੁਪਨਾ ਪੂਰਾ ਹੋ ਸਕੇ ਕਿ ਮੈਂ ਆਪਣਾ ਘਰ ਲਵਾਂ ਹੋਮ ਲੋਨ 'ਤੇ ਲੈ ਕੇ ਲੋਨ ਲੈ ਕੇ ਆਪਣਾ ਘਰ ਪਾਈਏ ਚਲੋ ਕੀ ਮੈਂ ਤਾਂ ਬੈਂਕ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਆਪਣੇ ਸਾਰੇ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਅਤੇ ਜਿਹਨਾਂ ਨਾਲ ਵਧੀਆ ਹੋ ਸਕੇ